ਹਾਂ ਮੈਂ ਆਪਣੇ ਪੂਰੇ ਦਿਨ ਵਿੱਚ ਬੜੇ ਹੀ ਅਲੱਗ ਅਲੱਗ ਮਾਡਨ ਉਪਕਰਣ ਵਰਤਦਾ ਹਾਂ ਜਿਵੇਂ ਕਿ ਮੋਬਾਈਲ ਲੈਪਟਾਪ ਸਮਾਰਟ ਵਾਚ ਔਰ ਇਸ ਤੋਂ ਇਲਾਵਾ ਕਈ ਹੋਰ ਉਪਕਰਣ ਵਰਤਦਾ ਹਾਂ ਮੋਬਾਇਲ ਪਹਿਲਾਂ ਜ਼ਰੂਰਤ ਸੀ ਅੱਜ ਕੱਲ੍ਹ ਸ਼ੌਂਕ ਹੈ ਹੁਣ ਸ਼ੌਂਕ ਇੱਕ ਆਦਤ ਵੱਲ ਤਬਦੀਲ ਹੋ ਚੁੱਕਾ ਹੈ ਜੋ ਕਿ ਬਹੁਤ ਹੀ ਗਲਤ ਦਿਸ਼ਾ ਵਿੱਚ ਜਾ ਰਿਹਾ ਹੈ ਜੇਕਰ ਅੱਜ ਮੋਬਾਇਲ ਲੈਪਟਾਪ ਨਾ ਹੋਣ ਤਾਂ ਜ਼ਿੰਦਗੀ ਵਿੱਚ ਕਈ ਤਰੀਕੇ ਨਾਲ ਬੇਚੈਨੀ ਅਤੇ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਅਸੀਂ ਸਾਰਾ ਆਪਣਾ ਧਿਆਨ ਆਪਣੀ ਪੜ੍ਹਾਈ ਆਪਣਾ ਆਫਿਸ ਦਾ ਵਰਕ ਸਾਰਾ ਕੁਝ ਇਸ 'ਤੇ ਸੀਮਿਤ ਕਰ ਲਿਆ ਹੈ ਮੋਬਾਇਲ ਲੈਪਟਾਪ ਇੱਕ ਜ਼ਰੂਰੀ ਵਰਤੋਂ ਬਣ ਚੁੱਕੀ ਹੈ ਮੋਬਾਈਲ ਨਾਲ ਅਸੀਂ ਇੱਕ ਦੂਜੇ ਨਾਲ ਸੰਪਰਕ ਕਰਦੇ ਹਾਂ ਲੇਕਿਨ ਅੱਜ ਦੇ ਸਮੇਂ ਮੋਬਾਇਲ ਇੱਕ ਆਦਤ ਬੁਰੀ ਆਦਤ ਕਹਿ ਸਕਦੇ ਹਾਂ ਅਸੀਂ ਉਹ ਬਣ ਚੁੱਕੀ ਹੈ ਜਿਹਦੇ ਨਾਲ ਅਸੀਂ ਹਰ ਵੇਲੇ ਰੀਲਾਂ ਹਰ ਵੇਲੇ ਗੰਦੀਆਂ ਚੀਜ਼ਾਂ ਹਰ ਵੇਲੇ ਗਲਤ ਇਨਫੋਰਮੇਸ਼ਨ ਅਸੀਂ ਇੱਕ ਦੂਜੇ ਨੂੰ ਭੇਜਦੇ ਰਹਿੰਦੇ ਹਾਂ ਜੋ ਕਿ ਸਮਾਜ ਨੂੰ ਵਿਗਾੜ ਰਿਹਾ ਹੈ ਜੇਕਰ ਅਸੀਂ ਉਪਕਰਨ ਨਾ ਹੋਣ ਤਾਂ ਸਾਡੀ ਜ਼ਿੰਦਗੀ ਬਹੁਤ ਸੁਥਰੀ ਹੋ ਸਕਦੀ ਹੈ ਬੰਦੇ ਨੂੰ ਆਪਸ ਵਿੱਚ ਮੇਲ ਮਿਲਾਪ ਵੱਧ ਸਕਦਾ ਹੈ ਬੰਦੇ ਉੱਤੇ ਆਪਸੀ ਭਾਈਚਾਰਾ ਵੱਧ ਸਕਦਾ ਹੈ ਗਲਤ ਵਿਚਾਰਧਾਰਾ ਬੰਦ ਹੋ ਸਕਦੀ ਹੈ ਜਿਹਦੇ ਨਾਲ ਸਮਾਜ 'ਤੇ ਇੱਕ ਅੱਛਾ ਅਸਰ ਪੈਂਦਾ ਹੈ